ਮੈਂ ਆਪਣੇ ਦੋਸਤ ਦਾ ਮੋਬਾਇਲ ਫੋਨ ਵੇਖ ਕੇ ਆਪਣੇ ਲਈ ਵੀ ਮੋਬਾਇਲ ਫੋਨ ਖ੍ਰੀਦਣ ਦੀ ਇੱਛਾ ਉਸਦੇ ਅੱਗੇ ਪ੍ਰਗਟ ਕੀਤੀ ਅਤੇ ਉਸਨੇ ਮੇਰੇ ਨਾਲ ਬਾਜ਼ਾਰ ਵਿੱਚ ਚੱਲ ਕੇ ਮੈਨੂੰ ਨਵਾਂ ਮੋਬਾਇਲ ਫੋਨ ਲੈ ਦਿੱਤਾ ਜਿਸ ਦੇ ਹਰ ਫੀਚਰ ਨੂੰ ਵੇਖ ਕੇ ਅੱਜ ਦੇ ਟੈਕਨੋਲਜੀ ਯੁੱਗ ਵਿੱਚ ਹੋ ਰਹੀਆਂ ਨਵੇਂ ਨਵੀਆਂ ਰਿਸਰਚਿਜ 'ਤੇ ਮੌਕਾ ਮਿਲਿਆ ਉਹਨਾਂ ਨੂੰ ਜਾਣਨ ਦਾ ਸੋ ਮੋਬਾਇਲ ਫੋਨ ਇੱਕ ਵਧੀਆ ਕਾਢ ਹੈ